ਜ਼ਿਆਦਾਤਰ ਇਲਾਕਿਆਂ ਵਿੱਚ ਹੋ ਰਹੇ ਅਪਰਾਧ ਦਾ ਕਾਰਨ ਜਿਹੜਾ ਹੈ ਉਹ ਬੇਰੋਜ਼ਗਾਰੀ ਹੈ ਕਿਉਂਕਿ ਬੇਰੋਜ਼ਗਾਰੀ ਜਿਹੜੀ ਹੈ ਉਹ ਗਰੀਬੀ ਨੂੰ ਸੱਦਾ ਦਿੰਦੀ ਹੈ ਔਰ ਗਰੀਬੀ ਜਿਹੜੀ ਹੈ ਉਹ ਅਪਰਾਧਾਂ ਨੂੰ ਇਹ ਕਹਿਣਾ ਗਲਤ ਨਹੀਂ ਹੈ ਕਿ ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਹਨ ਜਦੋਂ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਪੜ੍ਹਾਈ ਦੇ ਅਨੁਸਾਰ ਕੋਈ ਵੀ ਕਿੱਤਾ ਨਹੀਂ ਮਿਲਦਾ ਜਾਂ ਬੇਰੁਜ਼ਗਾਰ ਹੋ ਜਾਂਦੇ ਨੇ ਅਤੇ ਉਹ ਫਿਰ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੱਖ ਵੱਖ ਥਾਵਾਂ 'ਤੇ ਅਪਰਾਧੀਆਂ ਦੇ ਜਦੋਂ ਨਾਲ ਮਿਲ ਕੇ ਕੰਮ ਕਰਦੇ ਨੇ ਤਾਂ ਫਿਰ ਉਹ ਵੱਡੇ ਪੱਧਰ 'ਤੇ ਅਪਰਾਧੀਆਂ ਦੇ ਨਾਲ ਕੰਮ ਕਰਨ ਦੇ ਵਿੱਚ ਵੀ ਆਪਣੇ ਆਪ ਨੂੰ ਸਮਰਥ ਸਮਝਦੇ ਨੇ ਅਤੇ ਉਹ ਇੱਧਰਲੇ ਪਾਸੇ ਜ਼ਿਆਦਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਚਲੇ ਜਾਂਦੇ ਹਨ